ਨਵੀਂ ਟੈਕਨੋਲੋਜੀ ਨੇ ਬੰਦੇ ਨੂੰ ਬੜਾ ਬਿਜੀ ਕਰ ਦਿੱਤਾ ਹੈ ਉਸ ਕੋਲ ਬਜ਼ੁਰਗਾਂ ਕੋਲ ਬਹਿਣ ਦਾ ਜਾਂ ਬਜ਼ੁਰਗਾਂ ਨੂੰ ਗੱਲ ਕਰਨ ਦਾ ਟਾਈਮ ਹੀ ਨਹੀਂ ਰਹਿ ਗਿਆ ਹੁਣ ਤਾਂ ਸਿਰਫ ਫੋਨ 'ਤੇ ਹੀ ਗੱਲਾਂ ਹੁੰਦੀਆਂ ਹਨ ਫਿਜੀਕਲੀ ਬਹਿਣਾ ਗੱਲਾਂ ਸੁਣਨੀਆਂ ਗੱਲਾਂ ਕਰਨੀਆਂ ਇਹ ਹੋਣਾ ਚਾਹੀਦਾ ਹੈ ਸੰਭਵ ਹੋਣਾ ਚਾਹੀਦਾ ਹੈ ਤਾਂ ਕਿ ਬ ਬੱਚਿਆਂ ਨੂੰ ਬਜ਼ੁਰਗਾਂ ਨਾਲ ਬਹਿਣਾ ਅੱਛਾ ਲੱਗੇ